ਉੱਨੀ ਜੂਨ ਦੋ ਹਜ਼ਾਰ ਪੰਜ ਉੱਨੀ ਨਵੰਬਰ ਉੱਨੀ ਸੌ ਚੁਰਾਸੀ ਨੌ ਦਸੰਬਰ ਉੱਨੀ ਸੌ ਪੈਂਹਠ ਪੰਜ ਜਨਵਰੀ ਦੋ ਹਜ਼ਾਰ ਤਿੰਨ ਚਾਰ ਜੁਲਾਈ ਦੋ ਹਜ਼ਾਰ ਪੰਜ